ਬਿਮਾਰੀਆਂ ਤੋਂ ਬਚਣ ਲਈ ਸਾਨੂੰ ਸਿ ਚੰਗਾ ਖਾਣਾ ਜਾਂ ਫਿਰ ਸੰਤੁਲਿਤ ਭੋਜਨ ਖਾਣ ਦੀ ਲੋੜ ਹੁੰਦੀ ਹੈ ਯ ਇਹ ਅਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਸਿਰਫ਼ ਸੰਤੁਲਿਤ ਭੋਜਨ ਖਾਣ ਨਾਲ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਸਾਨੂੰ ਖਾਣ ਦੇ ਨਾਲ ਨਾਲ ਉਸ ਖਾਣੇ ਨੂੰ ਚੰਗੀ ਤਰ੍ਹਾਂ ਸਰੀਰ ਦੇ ਵਿੱਚ ਪਚਾਉਣ ਦੇ ਲਈ ਐਕਸਸਾਈਜ਼ ਕਰਨ ਦੀ ਵੀ ਲੋੜ ਜਾਂ ਫਿਰ ਕਹਿ ਲਉ ਕਿ ਕਸਰਤ ਕਰਨ ਦੀ ਵੀ ਲੋੜ ਪੈਂਦੀ ਹੈ ਹੁਣ ਕਸਰਤ ਦੇ ਵਿੱਚ ਅਸੀਂ ਯੋਗਾ ਕਰ ਸਕਦੇ ਹਾਂ ਜਿੰਮ ਜੁਆਇਨ ਕਰ ਸਕਦੇ ਹਾਂ ਜਾਂ ਫਿਰ ਆਪਣੀ ਖੁਦ ਭੱਜ ਦੌੜ ਕਰ ਕੇ ਘਰ ਦੇ ਕੰਮ ਕਰ ਕੇ ਵੀ ਆਪਣੀ ਸਿਹਤ ਨੂੰ ਦਰੁਸਤ ਰੱਖ ਸਕਦੇ ਹਾਂ